ਮੇਰਾ ਨਾਮ ਕਰਮਾ ਸਿੰਘ ਹੈ ਮੈਂ ਬਰਨਾਲਾ ਸ਼ਹਿਰ ਵਿਚ ਰਹਿੰਦਾ ਹਾਂ ਮੇਰਾ ਲੈੰਡ ਲਈਨ ਨੰਬਰ ਜ਼ੀਰੋ ਸੋਲਾਂ ਉਨਾਸੀ ਅਠਾਈ ਤਾਰਵੰਜਾ ਬਾਈ ਹੈ ਅਤੇ ਰਾਤੀ ਮੀਹ ਪੈਣ ਨਾਲ ਤਾਰਾਂ ਵਿੱਚ ਨੁਕਸ ਹੋਣ ਕਾਰਨ ਮੇਰੀ ਕਾਲ ਕੱਟ ਕੱਟ ਕੇ ਆ ਰਹੀ ਆ ਤੇ ਜਾ ਰਹੀ ਹੈ ਅਤੇ ਕੱਲ ਰਾਤੀ ਮੈਨੂੰ ਮੇਰੇ ਦੋਸਤ ਦਾ ਬਹੁਤ ਜਰੂਰੀ ਮੈਸੇਜ ਆਇਆ ਸੀ ਤੇ ਉਹ ਮੈਨੂੰ ਨਹੀਂ ਪ੍ਰਾਪਤ ਹੋ ਸਕਿਆ ਮੇਰੀ ਬੇਨਤੀ ਹੈ ਕਿ ਤੁਸੀਂ ਜਲਦ ਹੀ ਆ ਕੇ ਮੇਰੀ ਸਹਾਇਤਾ ਕਰੋ ਅਤੇ ਇਸ ਨੂੰ ਲੈਂਡਲਾਈਨ ਨੰਬਰ ਹੈ ਤੇ ਤਾਰਾਂ ਦਾ ਸਹੀ ਤਰੀਕੇ ਨਾਲ ਉਹਦਾ ਸਹੀ ਇਸਤੇਮਾਲ ਕਰਕੇ ਮੇਰੀ ਸਹਾਇਤਾ ਕੀਤੀ ਜਾਵੇ ਤਾਂ ਜੋ ਮੈਨੂੰ ਆਪਣੇ ਦੋਸਤਾਂ ਦਾ ਸਹੀ ਨੰਬਰ ਮਿਲ ਸਕੇ ਤੇ ਸਹੀ ਮੈਸੇਜ ਮਿਲ ਸਕੇ ਤਾਂ ਕਿ ਮੈਂ ਆਪਣੇ ਮੁਧਿਆ ਨੂੰ ਸੁਲਝਾ ਸਕਾ ਅਤੇ ਮੈਂ ਇਕ ਇੰਟਰਵਿਊ ਲਈ ਜਾਣਾ ਸੀ ਜਿਸ ਕਾਰਨ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਜਲਦ ਤੋਂ ਜਲਦ ਆਪਣਾ ਇੱਕ ਆਦਮੀ ਭੇਜ ਕੇ ਮੇਰੇ ਤਾਰਾਂ ਨੂੰ ਸੈੱਟ ਕੀਤਾ ਜਾਵੇ ਤੇ ਮੇਰੇ ਮੈਂ ਮੋਬਾਇਲ ਨੂੰ ਵੀ ਦੇਖਿਆ ਜਾਵੇ ਤਾਂ ਜੋ ਮੈਂ ਇੱਕ ਆਪਣੀ ਸਰਕਾਰੀ ਜੋਬ ਲਈ ਜਾ ਸਕਾ ਅਤੇ ਮੈ ਇਕ ਚੰਗੀ ਸਹੀ ਇੰਨਫ਼ੋਰਮਿਸ਼ਨ ਦੇ ਸਕਾ ਕਿਰਪਾ ਕਰਕੇ ਤੁਹਾਡੀ ਬਹੁਤ ਮਿਹਰਵਾਨੀ ਹੋਵੇਗੀ ਤੁਸੀਂ ਜਲਦ ਤੋਂ ਜਲਦ ਮੇਰੀ ਸਮੱਸਿਆ ਨੂੰ ਹੱਲ ਕਰੋ ਅਤੇ ਮੇਰੇ ਇਸ ਨੁਕਸ ਲਈ ਜੋ ਵੀ ਮੇਰਾ ਬਿੱਲ ਬਣਦਾ ਹੋਊਗਾ ਮੈਂ ਦੇਣ ਲਈ ਤਿਆਰ ਹਾਂ ਕਿਰਪਾ ਕਰਕੇ ਮੇਰੀ ਸਹਾਇਤਾ ਕੀਤੀ ਜਾਵੇ ਤਾਂ ਜੋ ਰੁਕ ਰੁਕ ਕੇ ਕਾਲਾ ਆ ਰਹੀਆਂ ਉਹਨਾਂ ਦਾ ਸਹੀ ਇਸਤੇਮਾਲ